ਮਨੁੱਖੀ ਜੀਵਨ ਵਿੱਚ ਸਫਾਈ ਦਾ ਵਿਸ਼ੇਸ਼ ਮਹੱਤਵ ਹੈ ਸਾਨੂੰ ਆਪਣੇ ਸਰੀਰ ਕੱਪੜਿਆਂ ਘਰ ਅਤੇ ਆਲੇ ਦੁਆਲੇ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਸ ਉਦੇਸ਼ ਦੀ ਪੂਰਤੀ ਲਈ ਹਰ ਰੋਜ਼ ਨਹਾਉਣਾ ਅਤੇ ਸਾਫ ਸੁਥਰੇ ਕੱਪੜੇ ਪਹਿਨਣਾ ਬਹੁਤ ਜ਼ਰੂਰੀ ਹੈ ਹਰ ਰੋਜ਼ ਘਰ ਦੀ ਸਫਾਈ ਹੋਣੀ ਵੀ ਬਹੁਤ ਜ਼ਰੂਰੀ ਹੈ ਕੂੜੇ ਨੂੰ ਕੂੜੇਦਾਨ ਵਿੱਚ ਸੁੱਟਣਾ ਅਤੇ ਇਸ ਨੂੰ ਉੱਪਰੋਂ ਢੱਕ ਕੇ ਰੱਖਣਾ ਬਹੁਤ ਹੀ ਜ਼ਰੂਰੀ ਹੈ ਤਾਂ ਜੋ ਮਨੁੱਖ ਮੱਖੀਆਂ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਦਾ ਬਚਾਅ ਹੋ ਜਾ ਸਕਦਾ ਹੈ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਵੀ ਢੱਕ ਕੇ ਰੱਖਣਾ ਬਹੁਤ ਜ਼ਰੂਰੀ ਹੈ ਘਰ ਦੇ ਅੰਦਰੂਨੀ ਅੰਦਰਲੀ ਸਫਾਈ ਦੇ ਨਾਲ ਨਾਲ ਘਰ ਦੇ ਆਲੇ ਦੁਆਲੇ ਦੀ ਸਫਾਈ ਸਥੋਆਰ ਰੱਖਣ ਦੀ ਲੋੜ ਹੈ ਗਲੀਆਂ ਅਤੇ ਨਾਲੀਆਂ ਦੀ ਹਰ ਰੋਜ਼ ਸਫਾਈ ਦੀ ਵਿਵਸਥਾ ਹੋਣੀ ਬਹੁਤ ਜ਼ਰੂਰੀ ਹੈ ਇਸ ਪਾਸੇ ਤੁਹਾਨੂੰ ਨਿੱਜੀ ਤੌਰ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਬਰਸਾਤੀ ਦਿਨਾਂ ਦੇ ਵਿੱਚ ਤਾਂ ਸਫਾਈ ਹੋਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਗੰਦਗੀ ਤੋਂ ਪੈਦਾ ਹੋਣ ਵਾਲੇ ਬਿਮਾਰੀਆਂ ਤੋਂ ਬਚਾਇਆ ਜਾ ਸਕਦਾ ਸਾਡੀਆਂ ਪੰਜਤੀਆਂ ਅਤੇ ਨਗਰ ਪਾਲਿਕਾ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਬਰਸਾਤਾਂ ਦੇ ਦਿਨ ਵਿੱਚ ਵਿਸ਼ੇਸ਼ ਤੌਰ 'ਤੇ ਡੀ ਟੀ ਦਾ ਛਿੜਕਾਅ ਹੋਣਾ ਜ਼ਰੂਰੀ ਹੈ ਜੇਕਰ ਸਾਡਾ ਘਰ ਅਤੇ ਆਲੇ ਦੁਆਲਾ ਸਾਫ ਸੁ ਹੋਵੇਗਾ ਤਾਂ ਹੀ ਮੱ ਸਵੱਛਤਾ ਭਾਰਤ ਦਾ ਸਾਡਾ ਸਫਨ ਸਾਕਾਰ ਹੋ ਸਕਦਾ ਹੈ ਜਿੱਦਾਂ ਕਿ ਸਰਕਾਰ ਦੁਆਰਾ ਇੱਕ ਮ ਮੁਸ਼ਫਤ ਭਾਰਤ ਬਣਾਉਣ ਦੀ ਅਗਵਾਈ ਵਾਲੇ ਇੱਕ ਪਹਿਲ ਹੀ ਇੱਕ ਮੁਹਿੰਮਾਂ ਦੋ ਅਕਤੂਬਰ ਦੋ ਜੀਰੋ ਇੱਕ ਚਾਰ ਨੂੰ ਮਹਿਨ ਮਹਾਨ ਵਿਅਕਤੀ ਮਹਾਤਮਾ ਗਾਂਧੀ ਦੀ ਇੱਕ ਚਾਰ ਪੰਜ ਵੀ ਜੈਅੰਤੀ ਮੌਕੇ ਭਾਰਤ ਸਰਕਾਰ ਦੁਆਰਾ ਅਧਿਕਾਰ ਤੌਰ 'ਤੇ ਚਲਾਈ ਗਈ ਸੀ ਇਹ ਰਾਜ ਘਾਟ ਨ ਨਵੀਂ ਦਿੱਲੀ ਮਹਾਤਮਾ ਗਾਂਧੀ ਦਾ ਸੰਸ ਸਰਕਾਰ ਸਥਾਨ ਵਿਖੇ ਅਰੰਭ ਕੀਤੀ ਗਈ ਸੀ ਭਾਰਤ ਸਰਕਾਰ ਨੇ ਇਸ ਮਹਿਮ ਮੁਹਿੰਮਾਂ ਨੂੰ ਜਾਰੀ ਦੋ ਅਕਤੂਬਰ ਦੋ ਜ਼ੀਰੋ ਇੱਕ ਨੌਂ ਤੱਕ ਭਾਰਤ ਨੂੰ ਮੱਛਫ ਭਾਰਤ ਬਣਾਉਣ ਦਾ ਟੀਚਾ ਰੱਖਿਆ ਹੈ ਇਸ ਇਹ ਦੇਸ਼ ਭਗਤੀ ਤੋਂ ਪ੍ਰੇਰਿਤ ਇੱਕ ਰਾਜਨੀਤੀ ਮੁਕਤ ਮੁਹਿੰਮ ਹੈ ਇਸ ਦੇਸ਼ ਨੂੰ ਸਵੱਛ ਦੇਨ ਬ ਦੇਸ਼ ਬਣਾਉਣ ਦੀ ਜਿੰਮੇਵਾਰੀ ਹਰ ਭਾਰਤ ਨਾਗਰਿਕ ਵਜੋਂ ਲਾਲਚ ਕੀਤੀ ਗਈ ਹੈ ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਲਾਈ ਗਈ ਹੈ